ਹਾਂਜੀ ਖੇਤੀ ਸੰਸਥਾਵਾਂ ਲਈ ਬਹੁਤ ਸਹੂਲਤਾਂ ਹਨ ਜੋ ਕਿ ਲੁਧਿਆਣਾ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਦੇ ਹੋਏ ਸਾਨੂੰ ਵਧੀਆ ਬੀਜ ਅਤੇ ਵਧੀਆ ਤਜਰਬੇ ਮਿਲਦੇ ਹਨ ਅਸੀਂ ਜਾਂਦੇ ਰਹਿੰਦੇ ਹਨ ਪ੍ਰੋਗਰਾਮਾਂ 'ਤੇ ਉਸ ਤੋਂ ਬਾਅਦ ਸਾਨੂੰ ਕੋਅਪਰੇਟ ਸੋਸਾਇਟੀ ਬੈਂਕਾਂ ਦੇ ਨਾਲ ਸਾਨੂੰ ਬਹੁਤ ਸਹੂਲਤਾਂ ਹਨ ਜੋ ਕਿ ਜ਼ਿਮੀਦਾਰ ਦੇ ਪਾਸ ਕੁਛ ਟਾਇਮ ਪੈਸਾ ਨਹੀਂ ਹੁੰਦਾ ਅਸੀਂ ਆਪਣਾ ਬੈਂਕ ਤੋਂ ਪੈਸਾ ਲੈ ਕੇ ਆਪਣੀ ਫਸਲ ਨੂੰ ਪਾਲ ਰਹੇ ਹਨ ਪਾਲ ਕੇ ਆਪਾਂ ਉਨ੍ਹਾਂ ਦਾ ਜੋ ਵੀ ਆਪਾਂ ਲੈਣ ਦੇਣ ਹੁੰਦਾ ਛੇ ਮਹੀਨੇ ਤੋਂ ਬਾਅਦ ਵਾਪਿਸ ਕੀਤਾ ਜਾਂਦਾ ਹਨ ਕਿ ਯੂਨੀਵਰਸਿਟੀਆਂ ਨਾਲ ਵੀ ਸਾਡਾ ਬਹੁਤ ਸੰਪਰਕ ਹੈ ਅਤੇ ਖੇਤੀਬਾੜੀ ਦੇ ਸੰਦਾਂ ਲਈ ਪੈਸਾ ਲੈਣਾ ਹੈ ਤਾਂ ਮਿਲ ਜਾਂਦੇ ਹਨ ਸਾਨੂੰ ਸੰਦ ਸਬਸਿਡੀ 'ਤੇ ਵੀ ਮਿਲਦੇ ਹਨ ਅਤੇ ਹੋਰ ਸਾਨੂੰ ਸਰਕਾਰੀ ਸਹੂਲਤਾਂ ਨਾਲ ਬਹੁਤ ਲਾਭ ਹੁੰਦਾ ਹਨ ਸਾਨੂੰ ਕੋਈ ਖੇਤੀ ਕਰਨ ਦਾ ਇਸ ਟੈਮ ਔਖਾ ਨਹੀਂ ਲੱਗਦਾ ਕਿ ਅੱਗੇ ਮੰਗੇ ਹੋਏ ਪੈਸੇ ਨਹੀਂ ਆੜਤੀ ਦਿੰਦੇ ਸਨ ਇਸ ਲਈ ਆਪਾਂ ਬੀਜ ਨਵੇਂ ਤਜਰਬੇਕਾਰ ਵਧੀਆ ਤੋਂ ਵਧੀਆ ਹਰ ਸਾਲ ਸਾਨੂੰ ਬੀਜਾਂ ਦੇ ਬਹੁਤ ਲਾਭ ਹੁੰਦੇ ਹਨ ਖੇਤੀ ਸਾਡੀ ਪਹਿਲਾਂ ਨਾਲੋਂ ਬੀਜਾਂ ਦੇ ਹਿਸਾਬ ਦੇ ਨਾਲ ਵਧੀਆ ਨਾਲ ਦੁੱਗਣੀ ਹੁੰਦੀ ਹੈ